ਮੈਨੂੰ ਔਨਲਾਈਨ ਸ਼ੋਪਿੰਗ ਦਾ ਜਿਹੜਾ ਬੜਾ ਸ਼ੌਕ ਹੈ ਕਿਉਂਕਿ ਮੈਂ ਕੁਕਿੰਗ ਦੀ ਸ਼ੌਕੀਨ ਹਾਂ ਇੱਕ ਦਿਨ ਮੈਂ ਪਲਾਸਟਿਕ ਦੇ ਜਿਹੜੇ ਕੰਟੇਨਰ ਹੈ ਫਲਿੱਪਕਾਰਡ ਤੋਂ ਔਡਰ ਕੀਤੇ ਜਿਹੜੇ ਜਿਨ੍ਹਾਂ 'ਤੇ ਕਾਫੀ ਮੈਨੂੰ ਔਫ ਮਿਲਿਆ ਅਤੇ ਦੇਖਣ 'ਚ ਬੜੇ ਸੋਹਣੇ ਲੱਗ ਰਹੇ ਸੀ ਅਤੇ ਬੜੀ ਵਧੀਆ ਪਲਾਸਟਿਕ ਲੱਗ ਰਹੀ ਸੀ ਪਰ ਜਦੋਂ ਮੇਰੇ ਕੋਲ ਔਡਰ ਪਹੁੰਚਿਆ ਤਾਂ ਉਨ੍ਹਾਂ ਦਾ ਮਤਲਬ ਕਿ ਜਿਹੜੀ ਸਭ ਤੋਂ ਪਹਿਲਾਂ ਉਹਨਾਂ ਦੀ ਪੈਕਿੰਗ ਬਹੁਤ ਗੰਦੇ ਤਰੀਕੇ ਵਾਲੀ ਹੋਈ ਵੀ ਸੀ ਸੈਕਿੰਡ ਉਹਨਾਂ ਦਾ ਜਿਹੜਾ ਢੱਕਣ ਹੈ ਉਹ ਕਰੈਕ ਸੀ ਥਰਡ ਜਦੋਂ ਮੈਂ ਉਹਨਾਂ ਦੀ ਪਲਾਸਟਿਕ ਚੈੱਕ ਕੀਤੀ ਤਾਂ ਪਲਾਸਟਿਕ ਬਹੁਤ ਮਤਲਬ ਘਟੀਆ ਪਲਾਸਟਿਕ ਸੀਗੀ ਜਿਹੜੀ ਸਾਡੀ ਹੈਲਥ ਲਈ ਵੀ ਪ੍ਰੋਬਲਮ ਆ ਸਕਦੀ ਸੀ ਜੇ ਅਸੀਂ ਉਹਨੂੰ ਯੂਜ ਕਰਦੇ ਤਾਂ ਮਤਲਬ ਉਹ ਪਲਾਸਟਿਕ ਇੰਨੀ ਮਤਲਬ ਉਹ ਸੀ ਕਿ ਇੱਦਾਂ ਲੱਗਦਾ ਸੀ ਕਿ ਹੱਥ 'ਚ ਫੜਨ ਤੋਂ ਬਾਅਦ ਉਹ ਟੁੱਟੇਗੀ ਫਿਰ ਮੈਂ ਉਸ ਤੋਂ ਬਾਅਦ ਔਡਰ ਨੂੰ ਜਿਹੜਾ ਰਿਪਲੇਸ ਲਈ ਰਿਕੁਐਸਟ ਕੀਤੀ ਕਾਫੀ ਦਿਨ ਜਿਹੜੀ ਮੇਰੀ ਰਿਪਲੇਸ ਦੀ ਉਹਨਾਂ ਨੇ ਜਿਹੜੀ ਉਹ ਚੱਕਿਆ ਨਹੀਂ ਹੈਗਾ ਉਸ ਤੋਂ ਬਾਅਦ ਜਦੋਂ ਰਿਪਲੇਸ ਹੋਇਆ ਤਾਂ ਜਿਹੜਾ ਸੈਕਿੰਡ ਟਾਈਮ ਜਿਹੜਾ ਰਿਪਲੇਸ ਹੋ ਕੇ ਆਏ ਉਹ ਵੀ ਉੱਦਾਂ ਦੇ ਹੀ ਸੀਗੇ ਸੇਮ ਸੇਮ ਪ੍ਰੋਡਕਟ ਆਏ ਫਿਰ ਮੈਂ ਸੋਚਿਆ ਕਿ ਅੱਜ ਤੋਂ ਬਾਅਦ ਜਿਹੜੇ ਪਲਾਸਟਿਕ ਕੰਟੇਨਰ ਹੈ ਇਹ ਔਨਲਾਈਨ ਦੀ ਬਜਾਏ ਜਿਹੜੇ ਮਾਰਕੀਟ ਦੇ ਵਿੱਚੋਂ ਖਰੀਦੇ ਜਾਣ ਤਾਂ ਜੋ ਸਾਨੂੰ ਜਿਹੜੇ ਕੰਟੇਨਰ ਚੈੱਕ ਹੋ ਕੇ ਅਸੀਂ ਦੇਖ ਸ ਦੇਖ ਕੇ ਲੈ ਸਕੀਏ ਵੀ ਸਾਡੀ ਸਾਡੇ ਲਈ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ